ਸੱਭਿਆਚਾਰ ਕਿਸੇ ਖਾਸ ਧਰਮ ਦੀ ਸਮੁੱਚੀ ਜੀਵਨ ਜਾਤੀ ਹੁੰਦੀ ਹੈ ਸੱਭਿਆਚਾਰ ਕਿਸੇ ਨਿਸ਼ਚਿਤ ਹੀ ਧਰਮ ਦੇ ਜੀਵਨ ਨਾਲ ਜੁੜੇ ਵੱਖ ਵੱਖ ਵਿਚਾਰਾਂ ਰਹਿਣ ਸਹਿਣ ਕਦਰਾਂ ਕੀਮਤਾਂ ਅਤੇ ਖਾਣ ਪੀਣ ਰੀਤੀ ਰਿਵਾਜਾਂ ਅਤੇ ਪਹਿਰਾਵੇ ਬੋਲੀ ਅਤੇ ਤੀਜ ਤਿਉਹਾਰਾਂ ਦਾ ਸੁਮੇਲ ਹੈ ਜਿੱਥੇ ਸੱਭਿਆਚਾਰ ਦੀ ਪ੍ਰਕਿਰਤਿਕ ਸਾਧਨਾ ਜਾਪਦੀ ਹੈ ਉੱਥੇ ਇਸ ਧਰ ਇਸਨੂੰ ਮਸ਼ਹੂਰ ਕਰਦੇ ਹੋਏ ਜਟਿਲ ਵਰਤਾਵਾ ਹੈ ਉਹ ਉਹ ਜਿੱਤਾਂ 'ਚੋਂ ਜੀਵਨ ਵਿੱਚ ਨਿਯਮ ਨੂੰ ਧਾਰਨ ਕਰੇ ਸੱਭਿਆਚਾਰ ਕਿਹਾ ਜਾਂਦਾ ਹੈ ਨਿਯਮ ਨਿਯਮਿਤ ਬੱਧਤਾ ਵਿੱਚ ਵਿਅਕਤੀ ਵਿਸ਼ੇਸ਼ ਵ ਵਿਸ਼ੇਸ਼ ਵੱਲ ਚੰਗੀ ਜੀਵਨ ਜਾਂਚ ਲਈ ਆਪਣੇ ਅਪਣਾਏ ਗਏ ਨੇਮ ਬੱਧ ਅਮ ਅਮੁੱਲ ਅਸੂਲ ਹੁੰਦੇ ਹਨ ਜਿਨ੍ਹਾਂ ਨੂੰ ਸਾਰੇ ਲੋਕ ਸਮੂਹ ਗੁੱਟ ਪ੍ਰਵਾਨ ਕਰਦੇ ਹਨ ਕੋਈ ਵੀ ਕੁਰੀਤੀ ਯਾਂ ਬੇਨਾਮੀ ਕਿਸੇ ਸੱਭਿਆਚਾਰ ਦਾ ਅੰਗ ਨਹੀਂ ਬਣ ਸਕਦੀ ਸਭ ਅਤੇ ਸਰਬ ਪ੍ਰਮਾਣਿਤ ਨਹੀਂ ਹੋ ਸਕਦੀ ਕਿਸੇ ਜੀਵਨ ਜਾਤੀ ਦੀ ਸੰਸਕ੍ਰਿਤ ਨੂੰ ਹਾਰ ਮੇਲਿਆਂ ਅਤੇ ਤਿਉਹਾ ਅਤੇ ਤਿਉਹਾਰਾਂ ਵਿੱਚ ਪੂਰੇ ਰੰਗ ਦਿਖਾਈ ਦਿੰਦੇ ਹਨ ਮਨੁੱਖ ਸਮਾਜ ਵਿੱਚ ਰਹਿੰਦਿਆਂ ਹੋਇਆ ਜਿਨ੍ਹਾਂ ਸਮਾਜਿਕ ਲੋੜਾਂ ਅਨੁਸਾਰ ਰੀਤੀ ਰਿਵਾਜ਼ਾਂ ਨੂੰ ਕਿਸੇ ਨਿਯਮ ਅਧੀਨ ਰ ਰਹਿਣ ਕਰਦਾ ਹੈ ਉਸਨੂੰ ਸੱਭਿਆਚਾਰ ਕਹਿੰਦੇ ਹਨ ਭਾਰਤ ਅਨੇਕਤਾ ਵਿੱਚ ਏਕਤਾ ਵੱਲ ਦਾ ਮੁਲਕ ਹੈ ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਵਿਭਿੰਨ ਸੱਭਿਆਚਾਰ ਪ੍ਰਾਪਤ ਹੁੰਦੇ ਹਨ ਇਹਨਾਂ ਵਿੱਚੋਂ ਇੱਥੇ ਵੱਖ ਵੱਖ ਰਾ ਰਾਜਿਆਂ ਦੇ ਆਪਣੇ ਆਪਣੀਆਂ ਰੀਤੀ ਰਿਵਾਜ਼ ਆਪਣੇ ਆਪਣੀਆਂ ਭਾਸ਼ਾਵਾਂ ਬੋਲੀਆਂ ਰਹਿਣ ਸਹਿਣ ਖਾਣ ਪੀਣ ਪਹਿਰਾਵਾ ਇੱਕ ਦੂਸਰੇ ਨਾਲ ਵੱਖਰਾ ਵੱਖਰਾ ਹੁੰਦਾ ਹੈ ਇਸ ਅਨੇਕਤਾ ਵਿੱਚ ਉਪ ਸੱਭਿਆਚਾਰ ਵਿਖਾਉਣਾ ਤਾਂ ਦੇ ਬਾਵਜੂਦ ਭਾਰਤੀ ਸੱਭਿਆਚਾਰ ਦਾ ਦੀ ਏਕਤਾ ਕਾਇਮ ਹੈ ਸਮਾ ਸਵਾ ਸਭਿਆਚਾਰ ਦਾ ਸੰਬੰਧ ਸਥਾਨਕ ਖੇਤਰਾਂ ਨਾਲ ਹੁੰਦਾ ਹੈ ਪੰਜਾਬ ਜੇ ਭਾਰਤ ਪੰਜਾਬ ਸੱਭਿਆਚਾਰ ਦਾ ਦੇ ਸਮ ਸੁੰਦਰ ਸਭ ਤੋਂ ਸੁੰਦਰ ਏ ਦੇਖੀ ਗਈ ਹੈ ਤਾਂ ਕਿ ਨਿਬੰਗ ਬੰਗਾਲੀ ਪੰਜਾਬੀ ਗੁਜਰਾਤੀ ਮਰਾਠੀ ਸਾਰੇ ਖੇਤਰਾਂ ਦੇ ਲੋਕ ਸ਼ਾਮਿਲ ਹਨ ਪਰ ਪੰਜਾਬ ਰਾਜ ਦਾ ਆਪਣਾ ਪੰਜਾਬੀ ਸੱਭਿਆਚਾਰ ਹੈ ਪੰਜਾਬੀ ਸੱਭਿਆਚਾਰ ਦੀ ਧਾਰਨਾ ਅੱਗੇ ਜੀਵਨ ਜਾਤੀਆਂ ਇਤਿਹਾਸ ਨਾਲ ਪ੍ਰਮੁੱਖ ਰੂਪ ਵਿੱਚ ਜੁੜੀਆਂ ਹੋਈਆਂ ਹਨ ਜਿੱਥੇ ਗਿੱਧਾ ਭੰਗੜਾ ਬੋਲੀਆਂ ਸੱਭਿਆਚਾਰ ਦਾ ਮੁੱਖ ਅੰਗ ਹੈ ਭਾਰਤ ਦੇ ਆਪਣੇ ਅਲੱਗ ਅਲੱਗ ਖੇਤਰਾਂ ਵਿੱਚ ਅਲੱਗ ਅਲੱਗ ਸੱਭਿਆਚਾਰ ਪ੍ਰਸਿੱਧ ਹਨ ਅਸਮ ਵਿੱਚ ਅਲੱਗ ਵਿੱਚ ਅਲੱਗ ਨੇ ਨਾਗਾਲੈਂਡ ਵਿੱਚ ਅਲੱਗ ਨੇ ਤਮਿਲਨਾਡੂ ਵਿੱਚ ਅਲੱਗ ਨੇ ਇਸ ਤਰ੍ਹਾਂ ਸਾਰੇ ਦੇਸ਼ ਭਾਰਤ ਦੇ ਵਿੱਚ ਸਭ ਦੇ ਆਪਣੇ ਆਪਣੇ ਨ੍ਰਿਤ ਪਹਿਰਾਵੇ ਖਾਣ ਪੀਣ ਸਭ ਦਾ ਆਪਣਾ ਆਪਣਾ ਹੈ ਪੰਜਾਬ ਅਮੀਰ ਅਤੇ ਖੁਸ਼ਹਾਲ ਖਿੱਤਾ ਹੋਣ ਕਰਕੇ ਇੱਥੇ ਦੇ ਲੋਕ ਚੰਗੇ ਹਨ ਜੀਵਨ ਬਸਰ ਕਰਦੇ ਹਨ ਉਹਨਾਂ ਦੇ ਉਹਨਾਂ ਨੂੰ ਨਿਰੰਤਰ ਨਿਰੰਤਰ ਵਿੱਚ ਰਹਿੰਦੇ ਹਨ ਅਤੇ ਬਹੁਤ ਸੋਹਣੀ ਤਰ੍ਹਾਂ ਆਪਣੇ ਸੱਭਿਆਚਾਰ ਨੂੰ ਨਿਭਾਉਂਦੇ ਹਨ ਅਤੇ ਉਸ ਸੱਭਿਆਚਾਰ ਦੇ ਅਧੀਨ ਆਪਣੇ ਬੱਚਿਆਂ ਦੀ ਵੀ ਪਰਵਰਿਸ਼ ਕਰਦੇ ਹਨ